ਹਾਂਜੀ ਹਾਂਜੀ ਹਾਂਜੀ ਕਿੱਦਾਂ ਤੁਸੀਂ ਹੋਰ ਦੱਸੋ ਜੀ ਹਾਂਜੀ ਹਾਂ ਸਭ ਵਧੀਆ ਹੋਰ ਘਰ ਪਰਿਵਾਰ ਸਭ ਠੀਕ ਜੀ ਅੱਜ ਕਿਵੇਂ ਯਾਦ ਕਰ ਲਿਆ ਤੁਸੀਂ ਅੱਛਾ ਜੀ ਅੱਛਾ ਜੀ ਮੈਂ ਵੀ ਮੈਂ ਵੀ ਤੁਹਾਨੂੰ ਫੋਨ ਕਰਨਾ ਓ ਸੀ ਇਸ ਬਾਰੇ ਸਕੂਲ ਬਾਰੇ 'ਚ ਗੱਲ ਕਰ ਵੀ ਇਹ ਦੋਨੋਂ ਇਕੱਠੇ ਜਾਂਦੇ ਨੇ ਆਪਾਂ ਵੀ ਕਿੱਥੇ ਲਵਾਈਏ ਉਹਨਾਂ ਨੂੰ ਸਕੂਲ ਵਧੀਆ ਸਕੂਲ ਕਿਹੜਾ ਫਤਿਹਗੜ੍ਹ ਦਾ ਮੈਂ ਪੁੱਛਣਾ ਸੀ ਤਹਾਨੂੰ ਜੀ

ਹਾਂਜੀ ਪੁੱਛਿਆ ਸੀ ਜੀ ਮੈਂ ਮੈਂ ਤੁਹਾਨੂੰ ਮੈਨੂੰ ਇੱਧਰ ਸਕੂਲਾਂ ਦਾ ਪਤਾ ਨਹੀਂ ਫਤਿਹਗੜ੍ਹ ਸਾਹਿਬ ਬਾਰੇ ਤੁਹਾਨੂੰ ਪਤਾ ਮੈਂ ਕਿਹਾ ਤੁਸੀਂ ਤੁਹਾਨੂੰ ਪੁੱਛ ਲੈਂਦਾ ਵਧੀਆ ਸਕੂਲ ਕਿਹੜਾ ਆ ਇੱਥੇ ਅਤੇ ਉਹਨਾਂ ਨੂੰ ਦੋਨਾਂ ਨੂੰ ਉੱਥੇ ਹੀ ਚਲਾ ਦੇਗੇ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਦੱਸਿਓ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਇਹਨਾਂ ਨੂੰ ਨੋਨ ਮੈਡੀਕਲ 'ਚ ਦਾਖਲਾ ਦਵਾਉਣਾ ਜੀ ਆਪਾਂ ਅੱਛਾ ਜੀ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਜੀ ਹਾਂਜੀ ਹਾਂ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ

ਹਾਂਜੀ ਹਾਂ ਹੋਰ ਕਿਹੜੇ ਕਿਹੜੇ ਸਕੂਲ ਨੇ ਜੀ ਹੋਰ ਕੋਈ ਸਕੂਲ ਹੈ ਅੱਛਾ ਜੀ ਚਲੋ ਫਿਰ ਮਿਲਦੇ ਹਾਂ ਜੀ ਠੀਕ ਹੈ ਜੀ ਓਕੇ